ਭਾਰਤ ਦੀ ਸਿਹਤ ਪ੍ਰਣਾਲੀ ਦੂਜੇ ਦੇਸ਼ਾਂ ਦੀ ਸਿਹਤ ਪ੍ਰਣਾਲੀ ਨਾਲੋਂ ਬਹੁਤ ਵਧੀਆ ਹੈ ਇਹ ਦੂਜੇ ਦੇਸ਼ਾਂ ਨਾਲੋਂ ਬਹੁਤ ਵਧੀਆ ਹੋਣ ਕਰਕੇ ਇੱਥੇ ਮਰੀਜ਼ਾਂ ਦਾ ਖਿਆਲ ਧਿਆਨ ਰੱਖਿਆ ਜਾਂਦਾ ਹੈ ਭਾਰਤ ਵਿੱਚ ਵਿਅਕਤੀਆਂ ਨੂੰ ਬਹੁਤ ਹੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਸਾਡੇ ਆਲੇ ਦੁਆਲੇ ਬਹੁਤ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਹਨ ਪਿੰਡਾਂ ਵਿੱਚ ਛੋਟੇ ਛੋਟੇ ਸਰਕਾਰੀ ਹਸਪਤਾਲ ਬਣੇ ਹੋਏ ਹਨ ਜੋ ਕਿ ਲੋੜ ਪੈਣ 'ਤੇ ਅਸੀਂ ਇਹਨਾਂ ਹਸਪਤਾਲਾਂ ਵਿੱਚੋਂ ਦਵਾਈ ਲੈ ਸਕਦੇ ਹਾਂ ਐਬੂਲੈਂਸ ਸੇਵਾਵਾਂ ਦੀ ਵਿਵਸਥਾ ਕੀਤੀ ਗਈ ਹੈ ਇੱਕ ਐਂਬੂਲੈਂਸ ਨੰਬਰ ਜਾਰੀ ਕੀਤਾ ਗਿਆ ਹੈ ਤਾਂ ਜੋ ਲੋੜ ਪੈਣ 'ਤੇ ਮਿਲਾਇਆ ਜਾਵੇ ਤਾਂ ਐਂਬੂਲੈਂਸ ਤੁਰੰਤ ਹਾਜ਼ਰ ਹੋ ਜਾਂਦੀ ਹੈ ਇਹਨਾਂ ਐਬੂਲੈਂਸਾਂ ਰਾਹੀਂ ਮਰੀਜ਼ਾਂ ਨੂੰ ਸ਼ਹਿਰ ਪਹੁੰਚਾਇਆ ਜਾਂਦਾ ਹੈ ਸਾਨੂੰ ਸਰਕਾਰੀ ਹਸਪਤਾਲਾਂ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਫ਼ਾਈ ਕਰਮਚਾਰੀ ਘੱਟ ਹੋਣ ਕਾਰਣ ਇੱਥੇ ਸਫ਼ਾਈ ਨਹੀਂ ਹੁੰਦੀ ਮੱਛਰ ਮੱਖੀ ਪੈਦਾ ਹੋ ਗਿਆ ਹੈ ਮੱਛਰ ਮੱਖੀ ਪੈਦਾ ਹੋਣ ਕਾਰਣ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਹਨ ਵੱਧ ਤੋਂ ਵੱਧ ਸਫ਼ਾਈ ਕਰਮਚਾਰੀ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ